ਸਰਕਾਰ ਨੇ ਲੋਕਾਂ ਦੇ ਜੀਵਨ ਨੂੰ ਸੁਧਾਰਨ ਲਈ ਕਾਫੀ ਨਵੀਂ ਚੀਜ਼ਾਂ ਸ਼ੁਰੂ ਕੀਤੀਆਂ ਨੇ ਜਿਵੇਂ ਕਿ ਦੋ ਅਲੱਗ ਅਲੱਗ ਰੰਗ ਦੇ ਡਸਟਬਿਨ ਲੋਕ ਆਪਣੇ ਕੂੜੇ ਨੂੰ ਦੋ ਅਲੱਗ ਰੰਗ ਦੇ ਡਸਟਬਿਨ ਦੇ ਵਿੱਚ ਪਾ ਸਕਦੇ ਨੇ ਇੱਕ ਰੰਗ ਹੈ ਬਾਇਓਡੀਗਰੇਡੇਬਲ ਸਬਸਟਾਂਸਿਸ ਪਾਉਣ ਵਾਸਤੇ ਤੇ ਦੂਸਰਾ ਹੈ ਨੋਨ ਬਾਇਓਡੀਗਰੇਡੇਬਲ ਸਬਸਟਾਂਸਿਸ ਪਾਉਣ ਵਾਸਤੇ ਉਸਦੇ ਨਾਲ ਜਦੋਂ ਵੀ ਕੂੜਾ ਚੱਕਣ ਵਾਸਤੇ ਲੋਕ ਆਉਂਦੇ ਨੇ ਤਾਂ ਫਿਰ ਉਹ ਬਾਇਓਡੀਗਰੇਡੇਬਲ ਸਬਸਟਾਂਸ ਨੂੰ ਅਲੱਗ ਜਗ੍ਹਾ ਰੱਖਦੇ ਨੇ ਅਤੇ ਨੋਨ ਬਾਇਓਡਿਗਰੇਡੇਬਲ ਸਬਸਟਾਂਸ ਨੂੰ ਅਲੱਗ ਜਗ੍ਹਾ ਰੱਖਦੇ ਨੇ ਜਿਹੜਾ ਵੀ ਬਾਇਓਡਿਗਰੇਡੇਬਲ ਸਬਸਟਾਂਸ ਹੁੰਦਾ ਹੈ ਉਹਨੂੰ ਉਹ ਮਿੱਟੀ ਦੇ ਵਿੱਚ ਪਾ ਕੇ ਉਹਦਾ ਮੈਨੂਅਰ ਬਣਾ ਦਿੰਦੇ ਨੇ ਜੋ ਕਿ ਅੱਗੇ ਖਾਦ ਬਣਾਉਣ ਦੇ ਵਿੱਚ ਕੰਮ ਆਉਂਦਾ ਹੈ ਅਤੇ ਉਹ ਅੱਗੇ ਫਾਰਮਰਸ ਨੂੰ ਦੇ ਦਿੰਦੇ ਨੇ ਜਿਹੜਾ ਨੋਨ ਬਾਇਓਡਿਗਰੇਡੇਬਲ ਸਬਸਟਾਂਸ ਹੁੰਦਾ ਹੈ ਉਹਨੂੰ ਅਲੱਗ ਜਗ੍ਹਾ ਰੱਖਿਆ ਜਾਂਦਾ ਹੈ ਅਤੇ ਉਹ ਬਿਲਕੁਲ ਵੀ ਪੋਲਿਊਸ਼ਨ ਨਹੀਂ ਕਰਦਾ ਉਸ ਤੋਂ ਬਾਅਦ ਜਿਹੜੀ ਸਟੇਟ ਏ ਉਹਨੇ ਕਾਫੀ ਨਵੇਂ ਟਰੈਫਿਕ ਰੂਲਸ ਯੂਜ ਕੀਤੇ ਨੇ ਡੇਟਾ ਕਲੈਕਸ਼ਨ ਦੇ ਨਾਲ ਜਿਵੇਂ ਕਿ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਵੀ ਕਿਹੜੀ ਸੜਕ ਹੈ ਜਿਹੜੀ ਠੀਕ ਨਹੀਂ ਹੈਗੀ ਅਤੇ ਕਿਹੜੀ ਸੜਕ ਹੈ ਜਿਹੜੀ ਠੀਕ ਹੈ ਇਹਦੇ ਨਾਲ ਲੋਕ ਆਪਣੇ ਕੰਮ ਕੰਮ ਦੇ ਵਾਸਤੇ ਸਹੀ ਟਾਈਮ 'ਚ ਪਹੁੰਚ ਜਾਂਦੇ ਨੇ ਅਤੇ ਉਹਨਾਂ ਨੂੰ